ਹੈਲੋ ਹਾਂਜੀ ਮੇਰਾ ਨਾਮ ਨੀਰੂ ਹੈ ਔਰ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਮੇਰਾ ਪੰਜਾਬ ਕੀ ਅੱਜ ਅਸੀਂ ਆਪਣੇ ਡਾਂਸ ਦੇ ਬਾਰੇ ਗੱਲ ਕਰਾਂਗੇ ਡਾਂਸ ਇੱਕ ਬਹੁਤ ਹੀ ਮਤਲਬ ਕਿ ਵਧੀਆ ਉਹ ਹੈ ਜਿਸ ਕਰਕੇ ਸਾਡੇ ਮਤਲਬ ਕਿ ਡਾਂਸ ਕਰਨ ਨਾਲ ਸਾਡੀ ਸਿਹਤਮੰਦ ਵੀ ਬਹੁਤ ਹੀ ਵਧੀਆ ਰਹਿੰਦੀ ਹੈ ਸਾਡੀ ਸਿਹਤ ਨੂੰ ਕਾਫੀ ਮਦਦ ਮਿਲਦੀ ਹੈ ਜਦੋਂ ਅਸੀਂ ਅੱਜ ਕੱਲ੍ਹ ਘਰਾਂ 'ਚ ਕਿੰਨੀਆਂ ਪਰੇਸ਼ਾਨੀਆਂ ਹਰ ਕੋਈ ਟੈਨਸ਼ਨ 'ਚ ਰਹਿੰਦਾ ਇਸ ਲਈ ਮੈਂ ਮਤਲਬ ਕਿ ਅਸੀਂ ਆਪਣਾ ਕੁਛ ਗੀਤ ਲਗਾ ਕੇ ਅਸੀਂ ਡਾਂਸ ਕਰਾਂਗੇ ਔਰ ਭੰਗੜਾ ਕਰਾਂਗੇ ਤਾਂ ਸਾਡਾ ਥੋੜ੍ਹਾ ਮਾਇੰਡ ਚੇਂਜ ਹੋ ਜਾਏਗਾ ਜਿਹਦੇ ਕਰਕੇ ਸਾਡੀ ਸਿਹਤ ਵੀ ਸਾਨੂੰ ਅੱਛੀ ਲੱਗੇਗੀ ਮਤਲਬ ਕਿ ਇੱਕ ਖੁਸ਼ਹਾਲ ਮਤਲਬ ਕਿ ਚਿਹਰੇ 'ਤੇ ਸਾਨੂੰ ਖੁਸ਼ੀ ਨਾਲ ਅਸੀਂ ਭਰ ਜਾਂਦੇ ਹਾਂ ਜਿਵੇਂ ਸਾਡੇ ਘਰਾਂ 'ਚ ਕੋਈ ਫੰਕਸ਼ਨ ਹੁੰਦਾ ਔਰ ਅਸੀਂ ਮਤਲਬ ਕਿ ਡਾਂਸ ਕਰਦੇ ਹਾਂ ਇਕਦਮ ਮਤਲਬ ਖਿਲ ਜਾਂਂਦੇ ਹਾਂ ਇਸ ਕਰਕੇ ਸਾਡਾ ਮਤਲਬ ਕਿ ਬਹੁਤ ਹੀ ਵਧੀਆ ਸਾਨੂੰ ਮਤਲਬ ਕਿ ਸਾਡਾ ਡਾਂਸ ਦੇ ਨਾਲ ਸਾਡੀ ਸਿਹਤ ਵੀ ਬਹੁਤ ਹੀ ਅੱਛੀ ਰਹਿੰਦੀ ਹੈ ਜਿਵੇਂ ਕਿ ਜਿਸ ਤਰ੍ਹਾਂ ਕੋਈ ਵਿਸਾਖੀ ਦਾ ਤਿਉਹਾਰ ਹੁੰਦਾ ਉਹਦੇ ਵਿੱਚ ਵੀ ਅਸੀਂ ਜਦੋਂ ਕਿਤੇ ਜਾਂਦੇ ਮਤਲਬ ਜਾਂਦੇ ਹਾਂ ਮੇਲੇ ਵੇਖਣ ਜਾਂ ਜਿਸ ਤਰ੍ਹਾਂ ਉੱਥੇ ਵੀ ਅਸੀਂ ਡਾਂਸ ਕਰਦੇ ਹਾਂ ਉਹ ਸਾਨੂੰ ਬਹੁਤ ਹੀ ਆਨੰਦ ਮਤਲਬ ਕਿ ਮਿਲਦਾ ਮਤਲਬ ਕਿ ਸਾਡੇ ਜਿਸ ਤਰ੍ਹਾਂ ਭੰਗੜਾ ਪੰਜਾਬ ਦਾ ਬਹੁਤ ਪ੍ਰਸਿੱਧ ਮਤਲਬ ਕਿ ਨਾਚ ਹੈ ਪੰਜਾਬ ਵਿੱਚ ਕੋਈ ਵੀ ਤਿਉਹਾਰ ਮਨਾਇਆ ਜਾਂਦਾ ਹੈ ਜਿਵੇਂ ਮਤਲਬ ਕਿ ਆਪਣੀ ਲੋਹੜੀ ਅਸੀਂ ਪਾਉਂਦੇ ਹਾਂ ਵਿਸਾਖੀ ਦਾ ਤਿਉਹਾਰ ਹੋ ਗਿਆ ਹੋਰ ਮਤਲਬ ਕਾਫੀ ਹੋਰ ਵੀ ਤਿਉਹਾਰ ਹੁੰਦੇ ਆ ਜਿਹਦੇ ਵਿੱਚ ਅਸੀਂ ਮਤਲਬ ਕਿ ਡਾਂਸ ਕਰਦੇ ਹਾਂ ਅਤੇ ਉਹ ਤਾਂ ਸਾਡੀ ਸਿਹਤ ਨੂੰ ਕਾਫੀ ਮਤਲਬ ਕਿ ਸਿਹਤਮੰਦ ਮਤਲਬ ਕਿ ਸਾਡੇ ਮਾਇੰਡ ਨੂੰ ਚੇਂਜ ਕਰਦਾ ਹੈ ਜਿਹਦੇ ਕਰਕੇ ਸਾਡੇ ਮਤਲਬ ਕਿ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ ਔਰ ਮਤਲਬ ਸਾਡਾ ਮਾਇੰਡ ਵੀ ਕਾਫੀ ਚੇਂਜ ਹੋ ਜਾਂਦਾ ਹੈ ਇਸ ਕਰਕੇ ਮਤਲਬ ਕਿ ਸਾਨੂੰ ਮਤਲਬ ਕਿ ਡਾਂਸ ਕਰਨਾ ਬਹੁਤ ਹੀ ਵਧੀਆ ਮਤਲਬ ਕਿ ਲੱਗਦਾ ਜਿਹਦੇ ਕਰਕੇ ਸਾਡਾ ਸਰੀਰ ਵੀ ਮਤਲਬ ਕਿ ਇਹਦੇ ਡਾਂਸ ਨਾਲ ਸਾਡਾ ਸਰੀਰ ਵੀ ਇਕਦਮ ਠੀਕ ਹੋ ਜਾਂਦਾ ਇਸ ਕਰਕੇ ਮਤਲਬ ਕਿ ਅਸੀਂ ਕਹਿੰਦੇ ਮੈਂ ਇਹੋ ਜਿਹੀ ਮਤਲਬ ਕਹਿਣਾ ਚਾਹਾਂਗੀ ਕਿ ਜੋ ਮਤਲਬ ਜਦੋਂ ਵੀ ਆਪਣੇ ਮਨ ਨੂੰ ਆਪਣੇ ਮਤਲਬ ਕਿ ਥੋੜ੍ਹੇ ਅਸੀਂ ਡਿਪਰੈਸ਼ਨ 'ਚ ਹੁੰਦੇ ਹਾਂ ਦੁਖੀ ਹੁੰਦੇ ਹਾਂ ਮਤਲਬ ਕਈ ਘਰਾਂ ਦੇ ਮਤਲਬ ਸੋਚਾਂ 'ਚ ਹੁੰਦੇ ਹਾਂ ਅਤੇ ਮੈਂ ਇਹੀ ਕਵਾਂ ਚਾਹੁੰਦੀ ਹਾਂ ਕਿ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ ਸਾਨੂੰ ਮਤਲਬ ਕਿ ਡਾਂਸ ਕਰਨਾ ਬਹੁਤ ਜ਼ਰੂਰੀ ਹੈ ਜਿਸ ਕਰਕੇ ਸਾਡੇ ਮਤਲਬ ਘਰ ਚਿਹਰੇ 'ਤੇ ਸਾਡੇ ਖੁਸ਼ੀ ਆਏਗੀ ਔਰ ਮਤਲਬ ਕਿ ਸਾਡਾ ਮਤਲਬ ਤੁਸੀ ਇੱਕ ਦਿਨ ਸਾਨੂੰ ਸਿਹਤਮੰਦ ਮਤਲਬ ਕਿ ਅਸੀਂ ਠੀਕ ਹੋਵਾਂਗੇ ਤੰਦਰੁਸਤ ਹੋਵਾਂਗੇ ਜੀ ਇਸ ਕਰਕੇ ਸਾਨੂੰ ਮਤਲਬ ਡਾਂਸ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਗਿੱਧਾ ਹੋ ਗਿਆ ਹੋਰ ਮਤਲਬ ਡੈਕ ਲਗਾ ਕੇ ਮਤਲਬ ਡੀ ਜੇ ਲਗਾ ਕੇ ਅਸੀਂ ਡਾਂਸ ਕਰਦੇ ਹਾਂ ਇਸ ਕਰਕੇ ਸਾਨੂੰ ਬਹੁਤ ਹੀ ਵਧੀਆ ਮਤਲਬ ਕਿ ਸਾਨੂੰ ਲੱਗਦਾ ਹੈ ਕਿ ਮਤਲਬ ਕਿ ਖੁਸ਼ੀ ਮਹਿਸੂਸ ਕਰਦੇ ਹਨ ਔਰ ਲੋਕ ਜਦੋਂ ਵੀ ਅਸੀਂ ਡਾਂਸ ਕਰਦੇ ਹਾਂ ਸਾਨੂੰ ਖੋ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਅਸੀਂ ਸਭ ਕੁਛ ਭੁੱਲ ਜਾਂਦੇ ਹਾਂ ਆਲੇ ਦੁਆਲੇ ਵਾਲੇ ਵੀ ਅਸੀਂ ਭੁੱਲ ਜਾਂਦੇ ਹਾਂ ਜਿਸ ਕਰਕੇ ਅਸੀਂ ਡਾਂਸ ਦੇ ਵਿੱਚ ਮਗਨ ਹੋ ਜਾਂਦੇ ਹਾਂ ਔਰ ਬਹੁਤ ਹੀ ਆਨੰਦ ਦੇ ਨਾਲ ਅਸੀਂ ਡਾਂਸ ਕਰਦੇ ਹਾਂ ਇਸ ਕਰਕੇ ਸਾਡਾ ਸਾਰਾ ਮਾਇੰਡ ਚੇਂਜ ਹੋ ਜਾਂਦਾ ਜਿਹਦੇ ਕਰਕੇ ਸਾਡੇ ਮਤਲਬ ਸਿਹਤ ਨੂੰ ਇਕਦਮ ਮਤਲਬ ਕਿ ਵਧੀਆ ਮਹਿਸੂਸ ਹੁੰਦਾ ਪਰ ਸਿਹਤਮੰਦ ਰਾਹੀਂ ਮਤਲਬ ਜੇ ਅਸੀਂ ਸਿਹਤਮੰਦ ਆਪਣੀ ਸਿਹਤ ਨੂੰ ਚੰਗਾ ਵੀ ਅਸੀਂ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਸਭ ਕਰਨਾ ਚਾਹੀਦਾ ਹੈ ਚਾਹੀਦਾ ਹੈ ਜਿਹਦੇ ਕਰਕੇ ਸਾਡਾ ਮਤਲਬ ਮਾਇੰਡ ਵੀ ਖੁਸ਼ ਮਤਲਬ ਠੀਕ ਠਾਕ ਹੋਏ ਔਰ ਚੀ ਅਸੀਂ ਵੀ ਔਰ ਸਰੀਰ ਵੀ ਸਾਡਾ ਤੰਦਰੁਸਤ ਰਹੇ ਔਰ ਸਿਹਤ ਮਤਲਬ ਕਿ ਅਸੀਂ ਵੀ ਖੁਸ਼ੀ ਨਾਲ ਭਰ ਜਾਈਏ ਔਰ ਸਾਡਾ ਮਾਇੰ ਮਤਲਬ ਕਿ ਅਸੀਂ ਹੁਣ ਸਰੀਰ ਵੀ ਸਾਡਾ ਠੀਕ ਰਹੇ ਇਸ ਕਰਕੇ ਡਾਂਸ ਬਹੁਤ ਹੀ ਸਾਡੀ ਸਿਹਤ ਲਈ ਜ਼ਰੂਰੀ ਹੈ ਧੰਨਵਾਦ ਜੀ ਥੈਂਕ ਯੂ